ਆਪਣੇ ਭਾਰਤੀ ਸੰਸਕ੍ਰਿਤ ਵਿੱਚ ਐਸੇ ਬਹੁਤ ਸਾਰੇ ਆਸਣ ਨੇ ਜੋ ਹਾਈਟ ਇੰਨਕਰੀਜ਼ ਵਿੱਚ ਮਦਦ ਮਦਦ ਕਰਦੇ ਆ ਸਭ ਤੋਂ ਪਹਿਲਾ ਹੈਗਾ ਜ ਜੋ ਮ ਮੇਰੀ ਨੌਲੇਜ 'ਚ ਹੈਗਾ ਉਹ ਹੈਗਾ ਸਮਸ਼ਥਿਨੀ ਆਸਣ ਜਾਂ ਤਦਾਆਸਣ ਉਸ ਤੋਂ ਇਲਾਵਾ ਹੈਗਾ ਪਦਸਥਆਸਣ ਫਿਰ ਚਕਰਆਸਣ ਫਿਰ ਧਨੂਰਾਆਸਣ ਇਹ ਕੁਛ ਕੁਛ ਆਸਣ ਹੈਗੇ ਆ ਆਪਣੇ ਭਾਰਤੀ ਸੰਸਕ੍ਰਿਤ ਯੋਗਾ ਵਿੱਚ ਜੋ ਇਨਸਾਨ ਨੂੰ ਉਹਦੀ ਹਾਰਟ ਇਨਕਰੀਜ ਕਰਨ ਵਿੱਚ ਮਦਦ ਕਰਦੇ ਆ